ਹਾਂਜੀ ਕਿਹੜੇ ਡਿਪਾਰਟਮੈਂਟ ਤੋਂ ਬੋਲ ਰਹੇ ਜੀ ਹਾਂਜੀ ਹਾਂਜੀ ਹਾਜੀ ਦੱਸੋ ਅੰਜ ਅਸੀਂ ਬੂਟਿਆਂ ਬਾਰੇ ਪੁੱਛ ਰਹੇ ਸੀ ਕਿਹੜੇ ਮੌਸਮ 'ਚ ਕਿਹੜਾ ਫਰੂਟ ਜਾਂ ਬਈ ਫਲ ਲਗਾਇਆ ਜਾਂਦਾ ਹੈ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੋ ਜਾਏਗਾ ਹਾਂਜੀ ਹੋਰ ਹੋਰ ਹਾਂ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂ ਹਾਂ ਹਾਂ ਹਾਂ ਠੀਕ ਹੈ ਜੀ ਠੀਕ ਹੈ

ਠੀਕ ਹੈ ਜਾਮਣ ਵੀ ਜ਼ਿਆਦਾ ਹੋ ਜਾਂਦੇ ਗਰਮੀ 'ਚ ਤਾਂ ਅੱਛਾ ਜੀ ਬਈ ਆਪਾਂ ਹੋਰ ਵੀ ਟਰਾਈ ਕਰ ਸਕਦੇ ਹਾਂ ਬਈ ਕਿਹੜਾ ਪੌਦਾ ਜਲਦੀ ਹੋ ਜਾਵੇ ਗਰਮੀ 'ਚ ਆਪਾਂ ਨੂੰ ਵਾਤਾਵਰਨ ਲਈ ਵੀ ਸਹੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੂਤ ਵੀ ਜਲਦੀ ਹੁੰਦਾ ਹੈ ਹਾਂਜੀ ਅਤੇ ਸਮਾਨ ਸਾਨੂੰ ਹਾਂਜੀ ਉਹ ਤਾਂ ਹਾਂਜੀ ਹਾਂਜੀ ਫਰੂਟ ਤਾਂ ਲੱਗ ਹੀ ਜਾਂਦੇ ਫਰੂਟ ਤਾਂ ਵੈਸੇ ਅਮਰੂਦ ਵੀ ਜਲਦੀ ਹੋ ਜਾਂਦਾ ਜ ਫਰੂਟ ਅਮਰੂਦ ਵਿੱਚ ਕਿੰਨ ਛੇ ਮਹੀਨੇ ਰਹਿੰਦਾ ਅਮਰੂਦਾਂ ਵਾਲਾ ਹਾਂ ਹਾਂ ਉਹ ਹਾਂ ਤੋਰੀਆਂ ਤੂਰੀਆਂ ਜਲਦੀ ਹੋ ਜਾਂਦੀਆਂ ਅੱਛਾ ਠੀਕ ਹੈ ਆਲੂ ਵੀ ਜਲਦੀ ਹਾਂਜੀ ਹਾਂਜੀ ਠੀਕ ਹਾਂ ਇਹ ਜਲਦੀ ਉਗਾਈ ਜਾਂਦੀ ਇਹੇ ਹਾਂਜੀ ਹਾਂਜੀ ਠੀਕ ਹੈ